ਅੱਜ ਦੇ ਯੁੱਗ ਵਿੱਚ ਕੋਈ ਵੀ ਨਵਾਂ ਅਤੇ ਪੁਰਾਣਾ ਕਾਰੋਬਾਰ ਕਰਨ ਲਈ ਤੁਹਾਨੂੰ ਐਡ ਵਿਗਿਆਪਨ ਅਤੇ ਵੱਖਵੱ ਖ ਤਰੀਕਿਆਂ ਨਾਲ ਲੋਕਾਂ ਤੱਕ ਪਹੁੰਚਣ ਦਾ ਜ਼ਰੀਆ ਵਧੀਆ ਅਤੇ ਸਸਤੇ ਅਤੇ ਚੰਗੇ ਢੰਗ ਨਾਲ ਬਹੁਤ ਹੀ ਜ਼ਰੂਰੀ ਹੈ ਕਿਉਂਕਿ ਜੇ ਆਪਾਂ ਕੋਈ ਵੀ ਨਵਾਂ ਕਾਰੋਬਾਰ ਕਰਨਾ ਹੈ ਤਾਂ ਉਸਨੂੰ ਦੱਸਣ ਲਈ ਲੋਕਾਂ ਤੱਕ ਪਹੁੰਚਣ ਲਈ ਇੱਕ ਮਾਧਿਅਮ ਹੈ ਜੋ ਇੱਕ ਤਰ੍ਹਾਂ ਦਾ ਆਪਾਂ ਪੈਂਪਲੇਟ ਹੁੰਦੇ ਹੈ ਜੋ ਅਖ਼ਬਾਰਾਂ ਵਿੱਚ ਦਿੰਦੇ ਹੈ ਅਖ਼ਬਾਰਾਂ ਦੇ ਜਦੋਂ ਪੈਂਪਲੇਟ ਬੰਦੇ ਕੋਲ ਘਰ ਜਾਂਦੇ ਹਨ ਤਾਂ ਉਹ ਪੜ੍ਹਦਾ ਹੈ ਤਾਂ ਆਟੋਮੈਟੀਕਲੀ ਉਸਦਾ ਪੈਂਪਲੇਟ ਪੜ੍ਹਨ 'ਤੇ ਤੁਹਾਡੇ ਦਿੱਤੇ ਇਸ਼ਤਿਹਾਰ ਮੁਤਾਬਕ ਤੁਹਾਡੇ ਕੋਲ ਆਉਂਦਾ ਹੈ ਅਤੇ ਤੁਹਾਡੀ ਦੁਕਾਨ 'ਤੇ ਤੁਹਾਡੇ ਕਾਰੋਬਾਰ 'ਤੇ ਵਿਜ਼ਿਟ ਕਰਦਾ ਹੈ ਜਿਸ ਨਾਲ ਇੱਕ ਤੁਹਾਨੂੰ ਚੰਗੀ ਰੁਚੀ ਮਿਲਦੀ ਹੈ ਅਤੇ ਚੰਗਾ ਤੁਹਾਡੇ ਲਈ ਰਿਸਪੋਂਸ ਆਉਂਦਾ ਹੈ ਇਸੇ ਤਰ੍ਹਾਂ ਦਿਵਾਲੀ ਤੋਂ ਦੋ ਦਿਨ ਪਹਿਲਾਂ ਦੀ ਗੱਲ ਹੈ ਜੋ ਕਿ ਸਾਡੇ ਨੇੜਲੇ ਸ਼ਹਿਰ ਵਿੱਚ ਇੱਕ ਅਖ਼ਬਾਰ ਅਤੇ ਇੱਕ ਡੇਲੀ ਰੂਟੀਨ ਦਾ ਫਤਿਹਗੜ੍ਹ ਸਾਹਿਬ ਟੂਡੇ ਆਉਂਦਾ ਹੈ ਉਸ ਦੇ ਵਿੱਚ ਐਡ ਆਈ ਸੀ ਵੀ ਜਿੰਨੇ ਵੀ ਮੱਧ ਵਰਗ ਦੇ ਲੋਕ ਨੇ ਉਹਨਾਂ ਲਈ ਦਿਵਾਲੀ 'ਤੇ ਆਪੋ ਆਪਣੇ ਕਾਰੋਬਾਰ ਰੱਖਣ ਲਈ ਬਿਲਕੁਲ ਫ੍ਰੀ ਜਗ੍ਹਾ ਦਿੱਤੀ ਜਾਂਦੀ ਹੈ ਮੈਂ ਜਦੋਂ ਉੱਥੇ ਜਾ ਕੇ ਦੇਖਿਆ ਉੱਥੇ ਲੋਕਾਂ ਨੇ ਆਪੋ ਆਪਣੇ ਹੱਥੀਂ ਤਿਆਰ ਕੀਤੇ ਦੀਵੇ ਬਹੁਤ ਹੀ ਵਧੀਆ ਤਰੀਕੇ ਨਾਲ ਰੰਗ ਕਰਕੇ ਜਿਵੇਂ ਸਜਾਏ ਹੋਏ ਸੀ ਉੱਥੋਂ ਬਹੁਤ ਹੀ ਜ਼ਿਆਦਾ ਲੋਕਾਂ ਨੇ ਲਏ ਲੈਣ ਵਾਲੇ ਨੂੰ ਵੀ ਸਸਤੀਆਂ ਚੀਜ਼ਾਂ ਮਿਲੀਆਂ ਅਤੇ ਦੇਣ ਵਾਲੇ ਨੂੰ ਵੀ ਬਹੁਤ ਹੀ ਸ਼ਾਂਤੀ ਮਿਲੀ ਇਸੇ ਤਰ੍ਹਾਂ ਬੱਤ ਹੱਥਾਂ ਨਾਲ ਵੱਟੀਆਂ ਹੋਈਆਂ ਬੱਤੀਆਂ ਅਤੇ ਹੱਟੜੀਆਂ ਅਤੇ ਹੋਰ ਦਿਵਾਲੀ ਨੂੰ ਰੁਸ਼ਨਾਉਣ ਘਰ ਲਈ ਚੰਗੇ ਤਰੀਕੇ ਨਾਲ ਵਧੀਆ ਦੇਖਣ ਅਤੇ ਤੁਹਾਡੇ ਘਰ ਦੀ ਸਜਾਵਟ ਕਰਨ ਲਈ ਉਸ ਜਗ੍ਹਾ 'ਤੇ ਬਹੁਤ ਹੀ ਵਧੀਆ ਜੋ ਕਿ ਇੱਕ ਉਪਰਾਲਾ ਜੋ ਕਿ ਇੱਕ ਸ਼ਲਾਘਾਯੋਗ ਉਪਰਾਲਾ ਕਹਿ ਸਕਦੇ ਹਾਂ ਜਿਸ ਨਾਲ ਆਮ ਅਤੇ ਮੱਧ ਵਰਗ ਦੇ ਲੋਕਾਂ ਨੂੰ ਰੋਜ਼ਗਾਰ ਵੀ ਮਿਲਿਆ ਅਤੇ ਲੋਕਾਂ ਨੂੰ ਚੀਜ਼ਾਂ ਵੀ ਸਸਤੀਆਂ ਮਿਲੀਆਂ